ਹਾਂਜੀ ਮੈਂ ਆਪਣੀ ਲੜਕੀ ਦੇ ਜਨਮ ਤੋਂ ਬਾਅਦ ਕਾਫੀ ਮੋਟੀ ਹੋ ਗਈ ਸੀ ਉਸ ਦੌਰਾਨ ਫਿਰ ਮੈਂ ਐਰੋਬਿਕਸ ਕਲਾਸਾਂ ਜੁਆਇਨ ਕੀਤੀਆਂ ਮੈਂ ਚਾਰ ਮਹੀਨੇ ਲਗਾਤਾਰ ਐਰੋਬਿਕਸ ਕਰਦੀ ਸੀ ਰੋਜ਼ ਵੀਹ ਮਿਨਟ ਮੈਂ ਲਗਾਤਾਰ ਐਰੋਬਿਕਸ ਕਰਦੀ ਸੀ ਜਿਸ ਨਾਲ ਮੇਰਾ ਬਾਰ੍ਹਾਂ ਕਿਲੋ ਭਾਰ ਘਟਿਆ ਮੇਰੇ 'ਚ ਇੰਨਾ ਕੋਨਫੀਡੈਂਸ ਆਇਆ ਮੇਰੀ ਉਮਰ ਲਗਭਗ ਮੈਨੂੰ ਲੱਗਿਆ ਜਿੰਨੀ ਹੈ ਉਸ ਤੋਂ ਦਸ ਸਾਲ ਛੋਟੀ ਹੋ ਗਈ ਮੈਂ ਅੱਜ ਵੀ ਐਰੋਬਿਕਸ ਐਕਸਰਸਾਈਜ ਕਰਦੀ ਹਾਂ ਅੱਜ ਵੀ ਮੈਂ ਭੰਗੜਾ ਕਰਦੀ ਹਾਂ ਮੈਂ ਵਿਆਹ ਸ਼ਾਦੀ 'ਤੇ ਵੀ ਭੰਗੜਾ ਕਰਦੀ ਹਾਂ ਅਗਰ ਮੇਰਾ ਜਿਸ ਦਿਨ ਦੀ ਮਨ ਬਹੁਤ ਉਦਾਸ ਹੁੰਦਾ ਹੁੰਦਾ ਹੈ ਮੈਂ ਆਪਣੇ ਘਰ ਵਿੱਚ ਮਿਊਜਿਕ ਲਗਾ ਕੇ ਵੀ ਭੰਗੜਾ ਕਰਦੀ ਹਾਂ ਐਰੋਬਿਕਸ ਕਰਦੀ ਹਾਂ ਐਰੋਬਿਕਸ ਕਰਨ ਨਾਲ ਤੁਹਾਡੇ ਸਰੀਰ ਦੀ ਪੂਰੀ ਐਕਸਰਸਾਈਜ਼ ਹੁੰਦੀ ਹੈ ਇਸ ਨਾਲ ਫੈਟ ਬਰਨ ਜਲਦੀ ਹੁੰਦਾ ਹੈ ਫੈਟ ਬਰਨ ਦੇ ਨਾਲ ਕੈਲਰੀਜ ਬਰਨ ਹੁੰਦੀਆਂ ਹਨ ਜਿਸ ਨਾਲ ਤੁਹਾਡਾ ਵਾਧੂ ਵਧਿਆ ਹੋਇਆ ਜਿਹੜਾ ਭਾਰ ਹੈ ਉਹ ਘੱਟ ਜਾਂਦਾ ਹੈ ਮੈਨੂੰ ਤਾਂ ਐਰੋਬਿਕਸ ਕਰਨਾ ਬਹੁਤ ਹੀ ਵਧੀਆ ਲੱਗਦਾ ਹੈ ਕਿਉਂਕਿ ਮੈਂ ਅੱਜ ਜਦ ਆਪਣੀਆਂ ਪੁਰਾਣੀਆਂ ਤਸਵੀਰਾਂ ਦੇਖਦੀ ਹਾਂ ਜਿਸ ਵਿੱਚ ਮੈਂ ਬਹੁਤ ਮੋਟੀ ਸੀ ਤਾਂ ਹੁਣ ਦੇਖਦੀ ਹਾਂ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਮੈਨੂੰ ਅੱਛਾ ਲੱਗਦਾ ਹੈ ਕਿ ਮੈਂ ਚੰਗੇ ਟਾਈਮ 'ਤੇ ਹੀ ਇਸ ਵੱਲ ਹੋ ਗਈ ਅਤੇ ਮੈਂ ਆਪਣਾ ਸਰੀਰ ਤੰਦਰੁਸਤ ਕਰ ਲਿਆ ਮੈਂ ਅੱਜ ਵੀ ਆਪਣੇ ਆਪ ਨੂੰ ਹਲਕਾ ਫੁਲਕਾ ਅਨੁਭਵ ਕਰਦੀ ਹਾਂ ਦੂਸਰਿਆਂ ਨੂੰ ਵੀ ਦੱਸਦੀ ਹਾਂ ਮੈਂ ਆਪਣੀ ਸਹੇਲੀਆਂ ਨੂੰ ਵੀ ਔਰਬਿਕਸ ਬਾਰੇ ਜਾਣਕਾਰੀ ਦਿੰਦੀ ਹਾਂ ਕਰਵਾਉਣੀ ਹਾਂ ਕਿ ਤੁਸੀਂ ਵੀ ਕਰੋ ਤਾਂ ਕਿ ਅਸੀਂ ਫਿਟ ਰਹਿ ਸਕੀਏ ਮਗਰ ਅਸੀਂ ਵਾਧੂ ਦਾ ਭਾਰ ਰੱਖਾਂਗੇ ਤਾਂ ਸਾਡੇ ਸਰੀਰ ਦੀਆਂ ਨਾਲ ਕਈ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਇਸ ਲਈ ਸਾਨੂੰ ਆਪਣੀ ਰੋਜ਼ ਮਰਾ ਜਿੰਦਗੀ ਵਿੱਚ ਅਜਿਹੀਆਂ ਐਕਸਰਸਾਈਜ ਕਰਨੀਆਂ ਚਾਹੀਦੀਆਂ ਹਨ ਧੰਨਵਾਦ